ਅੰਮ੍ਰਿਤਸਰ ਜ਼ਿਲ੍ਹੇ ਵਿੱਚ ਰੁਜ਼ਗਾਰ ਅਤੇ ਰੋਜ਼ੀ ਰੋਟੀ ਦੇ ਮੁੱਖ ਸ੍ਰੋਤ ਬਹੁਤ ਹਨ ਪਰ ਉਹਨਾਂ ਵਿੱਚੋਂ ਸਭ ਤੋਂ ਵੱਧ ਖੇਤੀਬਾੜੀ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਅੰਮ੍ਰਿਤਸਰ ਵਿੱਚ ਖੇਤੀਬਾੜੀ ਬਹੁਤ ਹੀ ਵੱਡੇ ਪੈਮਾਨੇ 'ਤੇ ਹੁੰਦੀ ਹੈ ਅੰਮ੍ਰਿਤਸਰ ਵਿੱਚ ਜ਼ਿਆਦਾਤਰ ਪਰਿਵਾਰ ਕਿਸਾਨ ਪਰਿਵਾਰ ਕਣਕ ਦੀ ਖੇਤੀਬਾੜੀ ਕਰਨਾ ਪਸੰਦ ਕਰਦੇ ਹਨ ਕਿਉਂਕਿ ਕਣਕ ਅੰਮ੍ਰਿਤਸਰ ਵਿੱਚ ਬਹੁਤ ਹੀ ਵੱਡੇ ਮਾਤਰਾ ਵਿੱਚ ਦੇਖਣ ਨੂੰ ਮਿਲਦੀ ਹੈ ਹਰ ਪਰਿਵਾਰ ਕਣਕ ਦੀ ਉਪਜਾਊ ਕਰਕੇ ਉਸ ਨੂੰ ਮੰਡੀ ਦੇ ਵੇਚ ਕੇ ਆਉਂਦਾ ਹੈ ਅਤੇ ਆਪਣੇ ਪਰਿਵਾਰ ਲਈ ਵੀ ਬਚਾ ਕੇ ਰੱਖਦੇ ਹਨ ਖੇਤੀਬਾੜੀ ਦੇ ਸਾਰੇ ਔਜ਼ਾਰ ਤੁਹਾਨੂੰ ਅੰਮ੍ਰਿਤਸਰ ਦੇ ਹਰ ਇੱਕ ਜ਼ਿਲ੍ਹੇ ਤੋਂ ਮਿਲ ਜਾਣਗੇ ਭਾਵੇਂ ਉਹ ਬੀਜ ਹੋਵੇ ਜਾਂ ਫਿਰ ਹੱਲ ਹੋਵੇ ਇੱਕ ਤਰ੍ਹਾਂ ਦਾ ਔਜ਼ਾਰ ਮਿਲ ਜਾਏਗਾ ਅਤੇ ਸਰਕਾਰਾਂ ਵੀ ਖੇਤੀਬਾੜੀ ਪਿੱਛੇ ਕੋਈ ਕਸਰ ਨਹੀਂ ਛੱਡਦੀਆਂ ਹਾ ਹਰ ਸਾਲ ਨਵੀਆਂ ਸਕੀਮਾਂ ਨਵੇਂ ਔਜ਼ਾਰ ਅਤੇ ਹੋਰ ਵੀ ਹਮੇਸ਼ਾ ਹੀ ਨਵੀਂ ਅਪ੍ਰੋਚ ਕਰਦੇ ਹਨ ਖੇਤੀਬਾੜੀ ਨੂੰ ਵਧਾਉਣ ਦੇ ਲਈ